ਹਾਂਜੀ ਮੈਮ ਹਾਂਜੀ ਮੈਮ ਬੋਲੀਏ ਹਾਂਜੀ ਮੈਮ ਹਾਂਜੀ ਮੈਮ ਵੋ ਸਟਾਰਟ ਕਰ ਦੀਆ ਹੈ ਐਚੂਅਲੀ ਤੋ ਇਸ ਲੀਏ ਟਾਈਮ ਨਹੀਂ ਲਗਾ ਜੈਸੇ ਜੈਸੇ ਟਾਈਮ ਲੱਗ ਰਹਾ ਹੈ ਵੈਸੇ ਵੈਸੇ ਕੰਪਲੀਟ ਹੋ ਰਹਾ ਹੈ ਮੈਮ ਹਾਂਜੀ ਮੈਮ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹੂੰ ਬਨਾਨੇ ਕੀ ਹਾਂਜੀ ਹਾਂਜੀ ਮੈਮ ਕੋਈ ਬਾਤ ਨਹੀਂ ਆਪ ਬੇਫਿਕਰ ਹੋ ਜਾਈਏ ਮੈਨੇ ਸਟਾਰਟ ਕਰ ਦੀਆ ਐਕਚੂਅਲੀ ਫੈਸਟੀਵਲਸ ਵੀ ਕਾਫ਼ੀ ਆ ਗਏ ਆਪਕੋ ਪਤਾ ਹੀ ਹੈ ਕਰਬਾਚੋਥ ਕਾ ਵਰਤ ਆ ਗਿਆ ਥਾ ਤੋ ਇਸ ਲੀਏ ਸੂਟਸ ਕਾਫ਼ੀ ਆ ਗਏ ਥੇ ਕਸਟਮਰ ਕੇ ਹਾਂਜੀ ਮੈਮ ਉਦੋਂ ਮੈਂ ਸਟਾਰਟ ਕਰ ਦਿੱਤਾ ਸੀ ਫਿਰ ਹੋਰ ਵੀ ਕਸਟਮਰ ਆ ਗਿਆ ਸੀ ਉਹਨਾਂ ਨੂੰ ਵੀ ਅਰਜਨਟਲੀ ਚਾਹੀਦਾ ਸੀ ਤਾਂ ਕਰਕੇ ਥੋੜ੍ਹਾ ਜਿਹਾ ਰਹਿ ਗਿਆ ਹਾਂਜੀ ਮੈਮ ਮੈਂ ਪੂਰੀ ਟਰਾਈ ਕਰ ਰਹੀ ਹਾਂ ਵੀ ਸਟਿਚਿੰਗ ਹੋ ਜਾਵੇ ਕੰਪਲੀਟ ਹਾਂਜੀ ਮੈਮ ਐਕਚੁਲੀ ਹੈ ਬਟ ਫਿਰ ਵੀ ਤੁਸੀਂ ਮੈਨੂੰ ਇੱਕ ਵਾਰ ਦੁਬਾਰਾ ਕਰ ਦਿਓ ਮੈਸਜ ਸੈਂਡ ਕਰ ਦਿਓ ਫੋਟੋ ਵਗੈਰਾ ਦੁਬਾਰਾ ਭੇਜ ਦਿਓ ਫਿਰ ਮੈਂ ਉਹਨੂੰ ਦੇਖ ਕੇ ਮੈਂ ਤੁਹਾਡਾ ਤਿਆਰ ਕਰਦਾਂਗੀ ਹਾਂਜੀ ਮੈਮ ਜਦੋਂ ਤੁਸੀਂ ਕਹੋ ਹੁਣ ਥੋੜ੍ਹਾ ਜਲਦੀ ਜਲਦੀ ਕਰ ਦਾਂਗੇ ਕਿਉਂਕਿ ਹੁਣ ਥੋੜ੍ਹਾ ਗੈਪ ਪੈ ਗਿਆ ਹਾਂਜੀ ਮੈਮ ਮੈਂ ਟਰਾਈ ਕਰਾਂਗੀ ਪੂਰੀ ਕੋਸ਼ਿਸ਼ ਤੁਹਾਡਾ ਹੀ ਹਾਂਜੀ ਹਾਂਜੀ ਮੈਮ ਪਹਿਲਾਂ ਮੈਂ ਤੁਹਾਡਾ ਹੀ ਸਟਿੱਚ ਕਰਾਂਗੀ ਫਿਰ ਹੀ ਬਾਕੀਆਂ ਦਾ ਦੇਖਾਂਗੀ ਹਾਂਜੀ ਮੈਮ ਹਾਂਜੀ ਹਾਂਜੀ ਤੁਸੀਂ ਇੱਕ ਵਾਰ ਦੁਬਾਰਾ ਕਰ ਦਿਓ ਫਿਰ ਮੈਂ ਦੇਖ ਕੇ ਸੈਂਡ ਕਰ ਦਾਂਗੀ ਹਾਂਜੀ ਹਾਂਜੀ ਮੈਮ ਜਿਵੇਂ ਤੁਹਾਡਾ ਸੂਟ ਸਟਿੱਚ ਹੋ ਜਾਵੇਗਾ ਇੱਕ ਵਾਰ ਤੁਸੀਂ ਟਰਾਈ ਕਰ ਲਿਓ ਪ੍ਰੋਪਰਲੀ ਫਿਟਿੰਗ ਵਗੈਰਾ ਪੂਰੀ ਹੈ ਜਾਂ ਨਹੀਂ ਫਿਰ ਦੁਬਾਰਾ ਤੁਹਾਨੂੰ ਠੀਕ ਲੱਗੇ ਤਾਂ ਫਿਰ ਤੁਸੀਂ ਪੇਮੈਂਟ ਕਰ ਦਿਓ ਨਹੀਂ ਤਾਂ ਜ ਜਦੋਂ ਤੱਕ ਕੰਪਲੀਟ ਨਹੀਂ ਹੁੰਦਾ ਇੱਕ ਵਾਰ ਤੁਸੀਂ ਰਹਿਣ ਦਿਓ ਨੋ ਨੋ ਮੈਮ ਕੋਈ ਕੋਈ ਇਸ਼ੂ ਨਹੀਂ ਹੈ ਤੁਸੀਂ ਆਰਾਮ ਨਾਲ ਆਪਣੀ ਪੇਮੈਂਟ ਕਰ ਦਿਓ ਉਹ ਤਾਂ ਪਹਿਲਾਂ ਸਾਡੇ 'ਤੇ ਕਿ ਅਸੀਂ ਤੁਹਾਡਾ ਕੰਪਲੀਟ ਕਰਕੇ ਦੇਈਏ ਸੂਟ ਕਿਉਂਕਿ ਤੁਸੀਂ ਪਹਿਲਾਂ ਤੋਂ ਦਿੱਤਾ ਹੋਇਆ ਸੀ ਅਤੇ ਉਹ ਐਕਚੁਲੀ ਥੋੜ੍ਹੀ ਪ੍ਰੋਬਲਮ ਹੋ ਗਈ ਸੀ ਫੈਸਟੀਵਲ ਕਰਕੇ ਕਸਟਮਰ ਕਾਫ਼ੀ ਆ ਗਏ ਸੀ ਇਸ ਲੀਏ ਥੋੜ੍ਹਾ ਲੇਟ ਹੋ ਗਿਆ ਅਤੇ ਬਟ ਹੁਣ ਤੁਹਾਡਾ ਹੀ ਸੂਟ ਸਟਿੱਚ ਕਰਨਾ ਮੈਮ ਤੁਹਾਡੇ ਜਿੰਨੇ ਤੁਸੀਂ ਡੇਟ ਮੈਨੂੰ ਦਿੱਤੀ ਹੈ ਉਸ ਤੋਂ ਪਹਿਲਾਂ ਹੀ ਮੈਂ ਕਰ ਦਾਂਗੀ ਅਤੇ ਤੁਸੀਂ ਟਰਾਈ ਕਰ ਲਿਓ ਆਕੇ ਦੇਖ ਲਿਓ ਹਾਂਜੀ ਹਾਂਜੀ ਹਾਂਜੀ ਮੈਮ ਓਕੇ ਬਾਏ ਮੈਮ